ਤਾਂ ਇਹ ਇੱਦਾਂ ਦੇ ਹੈਗੇ ਨੇ ਸਾਰਾ ਕੁਝ ਇਹ ਕੋਈ ਪਹਿਲਾਂ ਚੰਨ ਵੀ ਚੜਦਾ ਹੁੰਦਾ ਸੀਗਾ ਉਹਨੂੰ ਵੀ ਦੇਖਣ ਜਾਂਦੇ ਹੁੰਦੇ ਸੀ